ਮੈਂ ਹਮੇਸ਼ਾਂ ਇਹ ਪ੍ਰਯਾਸ ਕਰਦਾ ਹਾਂ ਕਿ ਮੈਂ ਜਿਹੜੇ ਵੀ ਵਾਕਾਂਸ਼ਾਂ ਗਤੀਸ਼ਿਲਾਂ ਅਤੇ ਵਿਆਖਿਆ ਨੂੰ ਆਪਣੇ ਗੀਤਾਂ ਵਿੱਚ ਯੂਜ ਇਸਤੇਮਾਲ ਕਰਾਂ ਉਹਨਾਂ ਦਾ ਇੱਕ ਮਤਲਬ ਹੋਵੇ ਜੋ ਕਿ ਕਿਸੇ ਵਿਅਕਤੀ ਸਥਾਨ ਜਾਂ ਕਿਸੇ ਦੀ ਭਾਵਨਾਵਾਂ ਨੂੰ ਜ਼ਾਹਿਰ ਕਰਨ ਲਈ ਇਸਤੇਮਾਲ ਹੋਵੇ ਮੈਂ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਮੇਰੇ ਕਿਸੇ ਸ਼ਬਦ ਤੋਂ ਕਿਸੇ ਦੀ ਭਾਵਨਾਵਾਂ ਹਰਟ ਹੋਣ 'ਤੇ ਹਮੇਸ਼ਾਂ ਚਾਹੁੰਦਾ ਹਾਂ ਕਿ ਲੋਕ ਇਸ ਨੂੰ ਮਜ਼ੇ ਨਾਲ ਸੁਣਨ ਕਦੇ ਵੀ ਇਹ ਕਿਸੇ ਲਈ ਦੁਖੀ ਦਾ ਕਾਰਨ ਨਾ ਬਣੇ ਗੀਤਾਂ ਹਮੇਸ਼ਾਂ ਇੱਕ ਖੁਸ਼ੀ ਦਾ ਕਾਰਨ ਹੋਣਾ ਚਾਹੀਦੇ ਹਾਂ ਜਿਸ ਕਰਕੇ ਸਾਨੂੰ ਸਾਰਿਆਂ ਨਾਲ ਵੱਧ ਜ਼ੋਰ ਜਿਹੜਾ ਹੈ ਇਹਨਾਂ ਸ਼ਬਦਾਂ ਅਤੇ ਆਪਣੇ ਗੀਤਕਾਰੀ 'ਤੇ ਦੇਣਾ ਪੈਂਦਾ ਹੈ ਅਸੀਂ ਹਮੇਸ਼ਾਂ ਚਾਹੁੰਦੇ ਹਾਂ ਕਿ ਐਸੇ ਜਿਹੇ ਸ਼ਬਦ ਇਸਤੇਮਾਲ ਕਰਨ ਕਿ ਜੋ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੀ ਅੰਦਰੂਨੀ ਭਾਵਨਾਵਾਂ ਅਤੇ ਉਹਨਾਂ ਦੇ ਜੋ ਪੁਰਾਣੇ ਖਿਆਲਾਤ ਜੋ ਕਿ ਦੁਖੀ ਖਿਆਲਾਤ ਜਾਂ ਉਹੋ ਜਿਹੇ ਖਿਆਲਾਤ ਨੇ ਉਹ ਦੂਰ ਹੋ ਸਕਣ ਅਤੇ ਉਹ ਇਕ ਚੰਗੇ ਰਾਹ 'ਤੇ ਚੱਲਣ ਲਈ ਅੱਗੇ ਵੱਧ ਸਕਣ ਅਤੇ ਉਹ ਕਦੇ ਵੀ ਕਿਸੇ ਗਲਤ ਰਾਹ 'ਤੇ ਨਾ ਜਾਣ ਅਤੇ ਉਹ ਗੀਤਾਂ ਰਾਹੀਂ ਮੈਂ ਚਾਹੁੰਦਾ ਹਾਂ ਕਿ ਲੋਕ ਜਿਹੜੇ ਗਲਤ ਰਾਹ 'ਤੇ ਜਾ ਚੁੱਕੇ ਹਨ ਉਹ ਵੀ ਵਧੀਆ ਰਾਹ 'ਤੇ ਆ ਸਕਣ ਅਤੇ ਮੈਂ ਉਹਨਾਂ ਨੂੰ ਇੱਕ ਨਜ਼ਰੀਆ ਦਿਖਾ ਸਕਾਂ ਕਿ ਜ਼ਿੰਦਗੀ ਕਿੱਦਾਂ ਜੀਅ ਜਾ ਸਕਦੀ ਹੈ ਅਤੇ ਜ਼ਿੰਦਗੀ ਜਿਉਣ ਦਾ ਇੱਕ ਵੱਖਰਾ ਨਜ਼ਰੀਆ ਵੀ ਹੁੰਦਾ ਹੈ ਵੱਖਰਾ ਤਰੀਕਾ ਵੀ ਹੁੰਦਾ ਜੋ ਕਿ ਬਹੁਤ ਜ਼ਰੂਰੀ ਹੈ ਜ਼ਿੰਦਗੀ ਜਿਉਣ ਲਈ ਅਤੇ ਹਮੇਸ਼ਾਂ ਸਾਨੂੰ ਉਹ ਵੀ ਪਹਿਲੂ ਆਪਣੀ ਜ਼ਿੰਦਗੀ ਦਾ ਯਾਦ ਰੱਖਣਾ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਕਿ ਇਹ ਆਪਣੇ ਕਲਚਰ ਸਮਾਜ ਆਪਣੇ ਭਾਸ਼ਾ ਸਭ ਦਾ ਧਿਆਨ ਰੱਖੀਏ ਅਤੇ ਹਮੇਸ਼ਾਂ ਆਪਣੇ ਭਾਰਤ ਨੂੰ ਉੱਪਰ ਰੱਖਣ ਲਈ ਹੀ ਗਾਈਏ ਅਤੇ ਕਦੇ ਵੀ ਇਹੋ ਜਿਹੇ ਕੋਈ ਗੀਤ ਨਾ ਗਾਈਏ ਜਿਹੜੇ ਤੁਹਾਡੇ ਦੇਸ਼ ਅਤੇ ਸਥਾਨ ਸਾਡੀ ਭਾਸ਼ਾ ਸਾਡੇ ਕਲਚਰ ਕਿਸੇ ਦਾ ਵੀ ਮਜ਼ਾਕ ਬਣੇ ਜਾਂ ਕੋਈ ਦੁਖੀ ਹੋਵੇ